ਹੈਲੋ ਹਾਂ ਸਤਿ ਸ਼੍ਰੀ ਅਕਾਲ ਭਾਅ ਜੀ ਮੈਂ ਅ ਬੋਲ ਰਹੀ ਹਾਂ ਅੰਮ੍ਰਿਤਸਰ ਤੋਂ ਮੈਂ ਆਪਣੇ ਘਰ ਦੀ ਨਾ ਇੰਟੀਰੀਅਰ ਡਿਜ਼ਾਇਨਿੰਗ ਕਰਵਾਉਣੀ ਹੈ ਔਰ ਰੈਨੋਵੇਸ਼ਨ ਕਰਵਾਉਣੀ ਹੈ ਐਕਚੁਲੀ ਮੇਰਾ ਮਕਾਨ ਜਿਹੜਾ ਹੈ ਉਹ ਕਾਫ਼ੀ ਸਾਲ ਪੁਰਾਣਾ ਤੀਹ ਚਾਲੀ ਸਾਲ ਹੋ ਗਏ ਇਸ ਨੂੰ ਬਣੇ ਹੋਏ ਨੂੰ ਔਰ ਹੁਣ ਮੇਰੇ ਬੇਟੇ ਦੀ ਮੈਰਿਜ ਹੈ ਔਰ ਮੈਂ ਇਸ ਲਈ ਇਹਨੂੰ ਰੈਨੋਵੇਟ ਕਰਵਾਉਣਾ ਚਾਹੁੰਦੀ ਹਾਂ ਔਰ ਥੋੜ੍ਹਾ ਇੰਟੀਰੀਅਰ ਡਿਜ਼ਾਇਨ ਵੀ ਕਰਵਾਉਣਾ ਚਾਹੁੰਦੀ ਹਾਂ ਤੇ ਮੈਂ ਥੋੜ੍ਹੀ ਤੁਹਾਡੇ ਨਾਲ ਸਲਾਹ ਕਰਨੀ ਕਿ ਕਿਸ ਤਰੀਕੇ ਨਾਲ ਹੋਏਗਾ ਇਹ ਠੀਕ ਹੈ ਜੀ ਠੀਕ ਹੈ ਜੀ ਜੀ ਅੱਛਾ ਜੀ ਠੀਕ ਹੈ ਅਤੇ ਰੋਸ਼ਨੀ ਮਤਲਬ ਰੋਸ਼ਨੀ ਲਈ ਕੀ ਮਤਲਬ ਤੁਹਾਨੂੰ ਰਿਕੁਆਇਰਮੈਂਟ ਕੀ ਲਾਈਟਨਿੰਗ ਟਿਊਬ ਬਲਬ ਹੋਣੀ ਚਾਹੀਦੀ ਹੈ ਕਿ ਨੈਚੁਰਲ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਹਾਂ ਹਾਂਜੀ ਇਹਦੀ ਭਾਅ ਜੀ ਹੈ ਕਿ ਉੱਪਰ ਸੈਕਿੰਡ ਫਸਟ ਫਲੋਰ 'ਤੇ ਸਾਡਾ ਜਿਹੜਾ ਰੂਮ ਹੈ ਉਹ ਇੱਕ ਫਰੰਟ ਰੂਮ ਹੈ ਇੱਕ ਅੱਗੇ ਬਾਲਕੋਨੀ ਵੀ ਹੈ ਬਾਲਕੋਨੀ ਤੋਂ ਆ ਰਹੀ ਹੈ ਸਾਡੇ ਅੰਦਰ ਉਸ ਤੋਂ ਬਾਅਦ ਨਾਲ ਹੀ ਪਿੱਛੇ ਕਿਚਨ ਹੈ ਕਿਚਨ ਦੇ ਉੱਪਰ ਵੀ ਬਿਲਕੁਲ ਮੁੱਗ ਹੈ ਔਰ ਉਥੋਂ ਵੀ ਸਾਡੀ ਕਾਫੀ ਲਾਈਟਨਿੰਗ ਕਿਚਨ 'ਚ ਵੀ ਆ ਰਹੀ ਹੈ ਈਵਨ ਕਿ ਡੇ ਟਾਈਮ ਸਾਨੂੰ ਲਾਈਟ ਜਗਾਉਣ ਦੀ ਲੋੜ ਨਹੀਂ ਪੈਂਦੀ ਇੰਨੀ ਲਾਈਟਨਿੰਗ ਹੈ ਔਰ ਉਹਦੀ ਲਾਈਟ ਬੈਕ ਬੈਕ ਰੂਮ 'ਚ ਵੀ ਆ ਰਹੀ ਹੈ ਉੱਥੇ ਅਤੇ ਕਲਰ ਮੈਂ ਬਸ ਇਹ ਚਾਹੁੰਦੀ ਹਾਂ ਕਿ ਮੇਰੇ ਬੇਟੇ ਦੀ ਮੈਰਿਜ ਹੈ ਅਤੇ ਇਹੋ ਜਿਹਾ ਹੋਏ ਕੀ ਥੋੜ੍ਹਾ ਬਰਾਈਟ ਕਲਰ ਹੋਣ ਜਿਹੜੇ ਨਿਊਲੀ ਮੈਰਿਡ ਕੱਪਲ ਨੂੰ ਅੱਛੇ ਲੱਗਣ ਅਤੇ ਇਸ ਤਰ੍ਹਾਂ ਦੇ ਕਲਰ ਸਾਨੂੰ ਚਾਹੀਦੇ ਹੈ ਕਿ ਹੋਣੇ ਚਾਹੀਦੇ ਹੈ ਵਿੱਚ

ਹਾਂਜੀ ਠੀਕ ਹੈ ਠੀਕ ਹੈ ਅਤੇ ਸਾਡੇ ਦੋ ਬੈਡਰੂਮ ਬਣਨਗੇ ਉਹ ਦੋ ਬੈਡਰੂਮ ਦੇ ਅਕੋਡਿੰਗ ਤੁਸੀਂ ਦੇਖਣਾ ਕਲਰ ਆਪਣੇ ਨੂੰ ਚੂਜ ਕਰਕੇ ਔਰ ਇੱਕ ਸਾਡਾ ਲਿਵਿੰਗ ਰੂਮ ਹੈ ਉਹਦੇ ਲਈ ਅਸੀਂ ਦੇਖ ਲਾਂਗੇ ਇੱਕ ਕਿਚਨ ਹੈ ਹੋਰ ਇਸ ਲਈ ਹੋਰ ਕੀ ਚਾਹੀਦਾ ਨਹੀਂ ਨਹੀਂ ਫਸਟ ਫਲੋਰ 'ਤੇ ਕਿਚਨ ਹੈ ਓਪਨ ਕਿਚਨ ਹੈ ਹਾਂਜੀ ਠੀਕ ਹੈ ਜੀ ਸਾਡੀ ਜਿਹੜੀ ਨੀਚੇ ਦਾ ਫਲੋਰ ਹੈ ਨਾ ਉਹਦੀ ਜਿਹੜੀ ਰੂਫ ਹੈ ਕਾਫ਼ੀ ਥੋੜ੍ਹਾ ਹਾਈ 'ਤੇ ਹੈ ਮੇ ਬੀ ਦਾ ਤੇਰ੍ਹਾਂ ਚੌਦ੍ਹਾਂ ਫੁੱਟ 'ਤੇ ਉੱਪਰ ਸਾਡੀ ਸੀਲਿੰਗ ਹੈ ਉਹ ਡਾਊਨ ਸੀਲਿੰਗ ਕਰਵਾ ਕੇ ਉਹ ਸਾਰੇ ਇੰਟੀਰੀਅਰ ਡਿਜ਼ਾਇਨ ਉਹਦੇ 'ਤੇ ਜ਼ਿਆਦਾ ਕਰਵਾਉਣਾ ਕਿਉਂਕਿ ਉੱਥੇ ਜ਼ਿਆਦਾ ਫੈਕਟ ਪਏਗਾ ਹਾਂਜੀ ਠੀਕ ਹੈ ਭਾਅ ਜੀ ਅਤੇ ਠੀਕ ਹੈ ਤੁਸੀਂ ਸਾਨੂੰ ਹਾਂਜੀ ਤੁਸੀਂ ਆਪਣਾ ਇਹਦਾ ਥੋੜ੍ਹਾ ਬਜਟ ਬਣਾ ਕੇ ਸਾਨੂੰ ਦੱਸ ਦੇਣਾ ਕਿ ਕਿੰਨੇ ਕੁ ਲੱਗੇਗਾ ਔਰ ਤੁਸੀਂ ਕਦੋਂ ਤੱਕ ਸਾਡੇ ਘਰ ਆ ਕੇ ਸਾਰਾ ਕੁਝ ਡਿਸਕਸ ਕਰ ਸਕਦੇ ਹੋ ਸਾਨੂੰ ਸਾਰਾ ਇ ਦੱਸ ਦੇਣਾ ਹਾਂ ਓਕੇ ਜੀ ਥੈਂਕ ਯੂ ਓਕੇ